ਰਾਜਨੀਤਿਕ ਲੋਕ ਰਾਜਨੀਤਿਕ ਦਬਦਬਾ ਬਣਾਉਣ ਦੇ ਲਈ ਜਿੱਥੇ ਧਾਰਮਿਕ ਖੇਤਰ ਦੇ ਜਾਂ ਧਰਮ ਦਾ ਫਾਇਦਾ ਉਠਾਉਂਦੇ ਹਨ ਜਾਂ ਧਰਮ ਨੂੰ ਵਪਾਰ ਵਜੋਂ ਵਰਤਦੇ ਹਨ ਇਹ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ